ਹਾਂਜੀ ਸ਼ਰਨ ਜੀ ਬੋਲਦੇ ਜੀ ਹਾਂਜੀ ਸ਼ਰਨ ਮੈਂ ਬੋਲਣਾ ਸੀਗਾ ਵੀ ਇੱਕ ਆਪਣੇ ਨਾ ਸਕੋਲਰਸ਼ਿਪ ਆਈਆਂ ਨੇ ਅੰਬੇਦਕਰ ਪੰਜਾਬ ਨੇ ਪੰਜਾਬ ਗੌਰਮੈਂਟ ਨੇ ਅਨਾਊਂਸ ਕੀਤੀਆਂ ਨੇ ਉਹਨਾਂ ਵਿੱਚ ਉਹਨਾਂ ਨੇ ਸਕੋਲਰਸ਼ਿਪ ਬਾਰੇ ਜਿਹੜੇ ਆਪਾਂ ਸਟੂਡੈਂਟਸ ਹਾਂ ਉਹਨਾਂ ਨੂੰ ਸਕੋਲਰਸ਼ਿਪ ਦੇ ਰਹੇ ਨੇ ਹਾਂਜੀ ਇਹਦੇ ਵਾਸਤੇ ਇੱਕ ਤਾਂ ਆਪਾਂ ਨੂੰ ਮਜ਼ੋਰਟੀ ਜਿੱਦਾਂ ਸਿੱਖ ਮਜ਼ੋਰਟੀ ਹੋ ਗਈ ਉਹਨਾਂ ਨੂੰ ਜ਼ਿਆਦਾ ਸਕੋਲਰਸ਼ਿਪ ਮਿਲ ਜਾਣੀ ਹੈ ਅਤੇ ਨਾਲ਼ ਜਿਨ੍ਹਾਂ ਦੀ ਜਿਹੜੀ ਇਨਕਮ ਆ ਉਹ ਦੋ ਲੱਖ ਤੋਂ ਘੱਟ ਹੋਵੇ ਅਤੇ ਤੀਸਰੇ ਨੰਬਰ 'ਤੇ ਜਿਹੜੀ ਇਲਜ਼ੀਬਿਲਟੀ ਹੁੰਦੀ ਆ ਉਹ ਇਹ ਵਾਲੀ ਆ ਕਿ ਜਿਹੜੇ ਆਪਣੇ ਪਲੱਸ ਟੂ 'ਚ ਮਾਰਕਸ ਆ ਉਹ ਮਤਲਬ ਕਿ ਸੱਠ ਪ੍ਰਸੈਂਟ ਹੋਣ ਦਸਵੀਂ ਜਾਂ ਪਲੱਸ ਟੂ ਸੱਠ ਪ੍ਰਸੈਂਟ ਹੋਣ ਉਹਨਾਂ 'ਤੇ ਮਿਲ ਅਤੇ ਆਪਾਂ ਫਿਰ ਇੱਦਾਂ ਕਰਦੇ ਫਿਰ ਉਹ ਫੋਰਮ ਫਿਲ ਕਰਦੇ ਹਾਂ ਦੋਨੋਂ ਜਣੇ ਔਨਲਾਈਨ ਹੀ ਅਪਲਾਈ ਕੋਈ ਖਰਚਾ ਨਹੀਂ ਹੁੰਦਾ ਉਹ ਕੈਫੇ ਵਾਲਿਆਂ ਨੇ ਲੈਣਾ ਹੁੰਦਾ ਵਾ ਬਸ

ਨਹੀਂ ਅਜੇ ਤਾਂ ਮੈਂ ਪੰਜਾਬ ਦੀ ਮੈਂ ਇੱਕੋ ਹੀ ਚੈੱਕ ਕੀਤੀ ਆ ਜੇ ਹੋਏਗੀ ਫਿਰ ਮੈਂ ਦੱਸਾਂਗਾ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਠੀ ਠੀ ਠੀਕ ਹੈ ਠੀਕ ਹੈ ਠੀਕ ਹੈ ਓਕੇ ਜੀ ਓਕੇ ਓਕੇ ਓਕੇ